ਭਾਰਤ ਦੀ ਭਾਰਤ ਦੀ ਰਾਜਨੀਤੀ ਬਾਰੇ ਗੱਲ ਕਰੀਏ ਤਾਂ ਭਾਰਤ ਦੇਸ਼ ਵਿੱਚ ਰਾਸ਼ਟਰੀ ਪੱਧਰ 'ਤੇ ਮੁੱਖ ਤੌਰ 'ਤੇ ਦੋ ਪਾਰਟੀਆਂ ਹਨ ਜਿਵੇਂ ਕਿ ਬੀ ਜੇ ਪੀ ਕਾਂਗਰਸ ਇਹਨਾਂ ਸਿਆਸੀਆਂ ਪਾਰਟੀਆਂ ਵਿੱਚੋਂ ਸਮੇਂ ਸਮੇਂ 'ਤੇ ਭਾਰਤ ਦੇਸ਼ ਦੀ ਬੇਹਤਰੀ ਲਈ ਕੰਮ ਕਰਦੀਆਂ ਹਨ ਜਿੱਥੋਂ ਤੱਕ ਜਿਵੇਂ ਲੋਕਤੰਤਰ ਦਾ ਸਵਾਲ ਹੈ ਭਾਰਤ ਇੱਕ ਬਹੁਤ ਵੱਡਾ ਲੋਕਤੰਤਰੀ ਦੇਸ਼ ਹੈ ਜਿਸ ਵਿੱਚ ਆਮ ਜਨਤਾ ਦੀ ਭਾਗੀਦਾਰੀ ਤਾਂ ਹੁੰਦੀ ਹੀ ਹੈ ਮੇਰਾ ਮਨ ਪਸੰਦ ਜਿਹੜੇ ਹੈਗੇ ਹੈ ਨੇਤਾ ਅੱਜ ਦੇ ਜਿਹੜੇ ਸ਼੍ਰੀ ਭਗਵੰਤ ਮਾਨ ਜੀ ਨੇ ਜੋ ਆਮ ਪਾਰਟੀ ਦੇ ਮੈਂਬਰ ਹਨ ਜੇਕਰ ਭਵਿੱਖ ਵਿੱਚ ਉਹਨਾਂ ਨੂੰ ਮਿਲਣ ਦਾ ਮੈਨੂੰ ਮੌਕਾ ਮਿਲਦਾ ਤਾਂ ਮੈਂ ਉਹਨਾਂ ਨੂੰ ਦੋ ਤਿੰਨ ਜਿਹੜੇ ਹੈਗੇ ਆਪਨੇ ਵੱਲੋਂ ਗੱਲਾਂ ਪੁੱਛਾਂਗੀ ਜਿਹੜੀਆਂ ਅੱਜ ਕੱਲ੍ਹ ਦੇ ਬਹੁਤ ਮੁੱਦੇ ਚੱਲ ਰਹੇ ਨੇ ਜਿਸ ਤਰ੍ਹਾਂ ਕਿ ਸਰਕਾਰੀ ਮੁਲਾਜ਼ਮ ਜਿਹੜੇ ਪੈਨਸ਼ਨ ਲਈ ਬਹੁਤ ਜ਼ਿਆਦਾ ਤਕਲੀਫ ਘੱਟ ਰਹੇ ਨੇ ਪੈਨਸ਼ਨ ਨਹੀਂ ਲੱਗੀ ਅਤੇ ਪੁਰਾਣੇ ਜਿਹੜੀ ਹੈਗੀ ਪੈਨਸ਼ਨ ਬਹਾਲੀ ਲਈ ਬਹੁਤ ਤੜਫ ਰਹੇ ਹੈ ਅਤੇ ਉਹਨਾਂ ਨੂੰ ਇਹੀ ਪੁੱਛਾਂਗੀ ਕਿ ਉਹਨਾਂ ਦਾ ਜਲਦੀ ਤੋਂ ਜਲਦੀ ਜਿਹੜਾ ਹੱਲ ਕੀਤਾ ਜਾਵੇ ਔਰ ਦੂਸਰੀ ਗੱਲ ਹੈਗੀ ਹੈ ਹੋਸਪਿਟਲ ਦੇ ਵਿੱਚ ਜਿਹੜੇ ਬਹੁਤ ਗਰੀਬ ਤੋਂ ਗਰੀਬ ਹੈਗੇ ਹੈ ਉਹਨਾਂ ਦੀ ਸਹੂਲਤਾਂ ਲਈ ਕੁੱਝ ਇਹ ਜਿਹਾ ਕਰਨਾ ਚਾਹੀਦਾ ਕਿ ਜਿਹੜੇ ਉਹ ਮਤਲਬ ਇੰਨੀ ਤਕਲੀਫ ਨਾ ਕੱਟਣ ਕਿ ਕਿਤੇ ਕਿਤੇ ਉਹਨਾਂ ਨੂੰ ਧੱਕੇ ਖਾਣੇ ਪੈ ਰਹੇ ਹੈ ਹੋਸਪਿਟਲਾਂ ਲਈ ਅਤੇ ਇਹੀ ਜਿਹੜੇ ਹੈਗੇ ਹੈ ਮੈਂ ਉਹਨਾਂ ਨੂੰ ਕੋਸ਼ਚਨ ਕਰਾਂਗੀ ਕਿ ਇੱਕ ਤਾਂ ਪੁਰਾਨੀ ਪੈਨਸ਼ਨ ਜਲਦੀ ਤੋਂ ਜਲਦੀ ਬਹਾਲ ਕੀਤੀ ਜਾਵੇ ਔਰ ਦੂਜਾ ਜਿਹੜਾ ਹੈਗਾ ਹੋਸਪਿਟਲ ਦੇ ਵਿੱਚ ਜਿਹੜੇ ਗਰੀਬ ਜਿਹੜੇ ਇਲਾਜ ਲਈ ਬਹੁਤ ਉਹਨਾਂ ਨੂੰ ਤੜਫਨਾ ਪੈਂਦਾ ਧੱਕੇ ਖਾਣੇ ਪੈਂਦੇ ਹੈ ਉਹਨਾਂ ਦਾ ਜਲਦ ਤੋਂ ਜਲਦਾ ਉਹਨਾਂ ਦਾ ਵੀ ਕੁਝ ਸੋਚਣਾ ਚਾਹੀਦਾ